ਸਕੂਲ ਦੇ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਦੇ ਲਈ ਕੁਝ ਸਹੂਲਤਾਂ ਪ੍ਰਾਪਤ ਨਹੀਂ ਹੁੰਦੀਆਂ ਜਿਹਨਾਂ ਕਾਰਨ ਬੱਚਿਆਂ ਦੀ ਪੜ੍ਹਾਈ ਵਿੱਚ ਕਮੀ ਰਹਿ ਜਾਂਦੀ ਹੈ ਜਿਵੇਂ ਉਹ ਬੱਚਿਆਂ ਨੂੰ ਕੁਛ ਲੈਕਚਰਸ ਸਿਖਾਉਂਦੇ ਹਨ ਜਿਨ੍ਹਾਂ ਦੇ ਰਾਹੀਂ ਬੱਚੇ ਹੋਰ ਗਹਿਰਾਈ ਦੇ ਵਿੱਚ ਉਹਨਾਂ ਟੋਪਿਕਸ ਨੂੰ ਕਲੀਅਰ ਕਰਦੇ ਨੇ ਪਰ ਉੱਥੇ ਨੈਟਵਰਕ ਇਸ਼ੂਸ ਦੇ ਕਾਰਨ ਬੱਚੇ ਚੰਗੀ ਤਰ੍ਹਾਂ ਉੱਥੇ ਆਪਣੇ ਵਿਸ਼ਿਆਂ ਨੂੰ ਗਹਿਰਾਈ ਵਿੱਚ ਨਹੀਂ ਸਮਝ ਪਾਉਂਦੇ ਤਾਂ ਪਹਿਲਾ ਕਾਰਨ ਅਧਿਆਪਕਾਂ ਨੂੰ ਪੜ੍ਹਾਉਣ ਦੇ ਲਈ ਰੁਕਾਵਟ ਜੋ ਬਣਦਾ ਹੈ ਉਹ ਨੈਟਵਰਕ ਇਸ਼ੂਸ ਹੁੰਦੇ ਹਨ ਦੂਸਰਾ ਸਕੂਲ ਦੇ ਨਿਯਮ ਹਨ ਉਹਨਾਂ ਦੀ ਸਖਤਾਈ ਹੁੰਦੀ ਹੈ ਕਿ ਸਕੂਲ ਦੇ ਵਿੱਚ ਕਿੰਨੀ ਕੁ ਸਖਤਾਈ ਹੈ ਹਰ ਸਕੂਲ ਦੇ ਵਿੱਚ ਸਖਤਾਈ ਦੀ ਲੋੜ ਹੁੰਦੀ ਹੈ ਨਿਯਮਾਂ ਦੀ ਲੋੜ ਹੁੰਦੀ ਹੈ ਤਾਂ ਜੋ ਬੱਚੇ ਉਹਨਾਂ ਦੀ ਪਾਲਣਾ ਕਰ ਸਕਣ